ਇਹ ਸਰ ਬਰ ਬ੍ਰਦਰ ਦੇ ਢਾਬੇ ਤੋਂ ਬੋਲਦੇ ਪਏ ਜੇ ਮੇਰਾ ਨਾ ਇੱਕ ਆਰਡਰ ਹੈਗਾ ਸੀ ਕਰਨਦੀਪ ਸਿੰਘ ਦੇ ਨਾਂ 'ਤੇ ਉਹ 'ਚ ਮੈਂ ਥੋੜ੍ਹਾ ਜਿਹਾ ਨਾ ਚੇਂਜ ਕਰਨਾ ਚੇਂਜ ਹੋ ਜਾਏਗਾ ਜੇ ਏ ਇੱਕ ਨਾ ਦੋ ਮੇਰੇ ਬਟਰ ਨਾਨ ਸੀ ਬਟਰ ਨਾਨ ਨੂੰ ਇੱਕ ਕਰ ਦਿਉ ਅਤੇ ਚਪਾਤੀਆਂ ਨਾ ਪੰਜ ਹੈਗੀਆਂ ਸੀ ਅਤੇ ਪੰਜ ਦੀ ਬਜਾਇ ਅੱਠ ਕਰ ਦਿਉ ਅਤੇ ਪੇ ਬਿਲ ਮੈਂ ਨਾ ਪੇ ਕਰ ਚੁੱਕਾ ਹੋਇਆ ਇਹਦਾ ਜੋ ਵੀ ਅਪਡੇਟ ਹੋਏਗਾ ਇਹਦੀ ਮੈਂ ਪੇਮੈਂਟ ਐਕਸਟਰਾ ਕਰ ਦੂੰਗਾ ਕੋਈ ਹੋਰ ਕੋਈ ਚਾਰਜਿਸ ਨਹੀਂ ਪਏਗਾ ਹਾਂਜੀ ਹੋ ਜੇਗਾ ਨਾ ਚਲੋ ਠੀਕ ਆ ਅਤੇ ਇਹਦਾ ਤਾਂ ਫਿਰ ਬਿਲ ਮੈਂ ਓਨਲਾਈਨ ਹੀ ਪੇ ਕਰ ਦਾਂਗਾ ਨਾ ਠੀਕ ਹੈ ਅਤੇ ਇਹ ਹੈ ਟਾਈਮ ਸਿਰ ਪਹੁੰ ਪਹੁੰਚ ਜਾਏਗਾ ਜੇ ਠੀਕ ਹੈ ਠੀਕ ਹੈ ਕਰਨਦੀਪ ਸਿੰਘ ਦੇ ਨਾਂ 'ਤੇ ਹੈਗਾ ਜੇ ਠੀਕ ਹੈ ਜੀ ਜੋ ਵੀ ਹੋਏਗਾ ਮੈਂ ਤੁਹਾਨੂੰ ਪੇ ਕਰ ਦਿੰਦਾ ਬਿਲ 'ਚ ਅਪਡੇਟ ਹੋਜੇਗਾ ਨਾ ਹਾਂਜੀ ਇਹੋ ਬਸ ਨਾਨ ਇੱਕ ਓਕੇ ਜੀ